ਹੈਲੋ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਉਹ ਪ੍ਰਧਾਨ ਸਾਹਿਬ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਸਤਿੰਦਰ ਭਾਜੀ ਤੋਂ ਹਾਂਜੀ ਹਾਂਜੀ ਹਾਂਜੀ ਤੁਸੀਂ ਆਪਣੇ ਗੁਰਦੁਆਰਾ ਚਰਨ ਕਮਲ ਸਾਹਿਬ ਠੀਕ ਆ ਜੀ ਮੈਂ ਨਾ ਜੀ ਆ ਮੈਂ ਇੱਧਰ ਘੁੰਮਣ ਫਿਰਨ ਲਈ ਜਾ ਰਿਹਾ ਸੀਗਾ ਤਾਂ ਮੈਂ ਸੋਚਿਆ ਵੀ ਇਸ ਪਲੇਸ 'ਤੇ ਵੀ ਜਾਇਆ ਜਾਵੇ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਅਤੇ ਤਾਂ ਇਹਨਾਂ ਬਾਰੇ ਮੈਨੂੰ ਮਾੜਾ ਮੋਟਾ ਦੱਸੋਗੇ ਇਤਿਹਾਸ ਬਾਰੇ ਜੀ ਕੀ ਹਿਸਾਬ ਕਿਤਾਬ ਆ ਵੀ ਗੁਰੂ ਸਾਹਿਬ ਕਦੋਂ ਆਏ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸੁਣਿਆ ਵਾ ਤਾਂ ਹੀ ਨਾ ਮੈਂ ਘੁੰਮਣ ਆ ਰਿਹਾ ਸੀ ਮੈਂ ਸੋਚਿਆ ਵੀ ਤੁਹਾਡਾ ਨੰਬਰ ਮਿਲਿਆ ਸੀ ਉਹ ਕਹਿੰਦੇ ਵੀ ਹਾਂਜੀ ਹਾਂਜੀ ਅੱਛਾ ਜੀ ਠੀਕ ਆ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਅਤੇ ਪ੍ਰਧਾਨ ਸਾਹਿਬ ਆਪਾਂ ਨੂੰ ਇੱਥੇ ਰਹਿਣ ਲਈ ਜਗ੍ਹਾ ਮਿਲ ਜਾਊਗੀ ਸਰਾਂ ਹੈਗੀਆਂ ਨੇ ਠੀਕ ਆ ਜੀ ਅਤੇ ਸਰਾਂ ਦੇ ਵਿੱਚ ਅਤੇ ਕਮਰਿਆਂ ਲਈ ਸਾਨੂੰ ਕੋਈ ਪੇਮੈਂਟ ਦੇਣੀ ਪਏਗੀ ਜਾਂ ਫਰੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਕੋਲ ਕੋਈ ਬੈਂਕ ਜਾਂ ਏ ਟੀ ਐਮ ਹੈਗਾ ਜੀ ਅੱਛਾ ਅੱਛਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਅਸੀਂ ਨਾ ਆਉਣਾ ਸੀਗਾ ਸੋਮਵਾਰ ਹਾਂਜੀ ਅਸੀਂ ਨਾ ਸੋਮਵਾਰ ਨੂੰ ਆਉਣਾ ਸੀਗਾ ਅਤੇ ਤੁਸੀਂ ਜੇ ਮਿਲ ਜਾਂਦੇ ਤਾਂ ਵਧੀਆ ਸੀਗਾ ਨਾਲ ਚਲੇ ਜਾਂਦੇ ਸਾਡੇ ਮਾੜਾ ਮੋਟਾ

ਤੁਸੀਂ ਗਾਈਡ ਦੇ ਤੌਰ 'ਤੇ ਸਾਡੇ ਨਾਲ ਚੱਲਿਓ ਨਾ ਸਾਨੂੰ ਪਤਾ ਨਹੀਂ ਏਰੀਏ ਦਾ ਅਸੀਂ ਨਵੇਂ ਇਸ ਏਰੀਏ ਦੇ ਵਿੱਚ ਹਾਂਜੀ ਬਹੁਤ ਵਧੀਆ ਜੀ ਫਿਰ ਤਾਂ ਸਾਨੂੰ ਏਰੀਏ ਦੇ ਬਾਰੇ ਪਤਾ ਨਹੀਂ ਨਾ ਸਾਨੂੰ ਪਤਾ ਲੱਗ ਜਾਊ ਆਸੇ ਪਾਸੇ ਸਾਰੇ ਗੁਰਦੁਆਰੇ ਘੁੰਮ ਲਵਾਂਗੇ ਅੱਛਾ ਅੱਛਾ ਠੀਕ ਹੈ ਜੀ ਅਤੇ ਸਾਡੇ ਰਹਿਣ ਦਾ ਖਾਣ ਦਾ ਪ੍ਰਬੰਧ ਤੁਹਾਡੇ ਹੱਥ ਹੀ ਆ ਜੀ ਨਾ ਜੀ ਘਾਟਾ ਤਾਂ ਕੋਈ ਨਹੀਂ ਫਿਰ ਵੀ ਮਾੜਾ ਮੋਟਾ ਰਹਿਣ ਸਹਿਣ ਦਾ ਸਾਡਾ ਸਾਡਾ ਪ੍ਰਬੰਧ ਕਰ ਦਿਓ ਰਹਿਣ ਸਹਿਣ ਦਾ ਸਾਡਾ ਹਾਂਜੀ ਹਾਂਜੀ ਅਸੀਂ ਚਾਰ ਪੰਜ ਜਾਣੇ ਆ ਨਾਲ ਵਿਧ ਫੈਮਿਲੀ ਆ ਸਾਡੀ ਹਾਂਜੀ ਤੁਹਾਨੂੰ ਜ਼ਰੂਰ ਮਿਲਣਾ ਜੀ ਅਸੀਂ ਅਤੇ ਨਾਲੇ ਪਰਚੀ ਕਟਾਉਣੀ ਆ ਅਤੇ ਥੋੜ੍ਹੀ ਬਹੁਤੀ ਸੇਵਾ ਜ਼ਰੂਰ ਦੇ ਕੇ ਜਾਵਾਂਗੇ ਮਾਇਆ ਜੀ ਹਾਂਜੀ ਠੀਕ ਆ ਜੀ ਹੋਰ ਹਾਂਜੀ ਹਾਂਜੀ ਵਧੀਆ ਜੀ ਤੇ ਇੱਥੋਂ ਆਪਣੇ ਕੋਈ ਗੱਡੀ ਵਗੈਰਾ ਬੁੱਕ ਹੋ ਜਾਂਦੀ ਆ ਗੁਰਦੁਆਰਾ ਸਾਹਿਬ ਤੋਂ ਅੱਛਾ ਜੀ

ਹਾਂਜੀ ਅਸੀਂ ਤਾਂ ਜਲੰਧਰ ਤੋਂ ਆਉਣਾ ਵਾ ਇੱਥੇ ਕਿੰਨੇ ਕਿਲੋਮੀਟਰ ਪੈ ਜਾਂਦਾ ਜੀ ਠੀਕ ਹੈ ਜੀ ਤੁਸੀਂ ਸਾਨੂੰ ਜ਼ਰੂਰ ਮਿਲਿਓ ਅਸੀਂ ਆ ਰਹੇ ਹਾਂ ਸੋਮਵਾਰ ਨੂੰ ਹਾਂਜੀ ਠੀਕ ਆ ਠੀਕ ਆ ਚਲੋ ਠੀਕ ਆ ਜੀ ਸਤਿੰਦਰ ਭਾਜੀ ਨੇ ਤੁਹਾਡਾ ਨੰਬਰ ਦਿੱਤਾ ਸੀ ਕਹਿੰਦੇ ਵੀ ਪ੍ਰਧਾਨ ਸਾਹਿਬ ਨਾਲ ਗੱਲ ਕਰ ਲਿਓ ਉਹ ਤੁਹਾਨੂੰ ਗਾਈਡ ਕਰਨਗੇ ਅਤੇ ਇਤਿਹਾਸ ਬਾਰੇ ਵੀ ਦੱਸਣਗੇ ਅਤੇ ਤੁਹਾਡਾ ਰਹਿਣ ਸਹਿਣ ਦਾ ਪ੍ਰਬੰਧ ਵੀ ਕਰ ਦੇਣਗੇ ਹਾਂ ਜੀ ਤੁਸੀਂ ਜਾਣਦੇ ਹੋ ਸਤਿੰਦਰ ਸਰ ਨੂੰ ਠੀਕ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਸਤਿੰਦਰ ਭਾਜੀ ਦਾ ਕੀਰਤਨ ਮੈਂ ਸੁਣਿਆ ਬਹੁਤ ਆਨੰਦਮਈ ਕੀਰਤਨ ਕਰਦੇ ਨੇ ਚਲੋ ਠੀਕ ਆ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ